ਲੋਕਾਂ ਨੂੰ ਆਪਣੇ ਰਾਜ ਦੇ ਭੂਗੋਲ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਰਾਜ ਦੇ ਭੂਗੋਲ ਦੀ ਜਾਣਕਾਰੀ ਦੇ ਨਾਲ ਹੀ ਜਿਹੜਾ ਅਸੀਂ ਆਪਣੇ ਆਪ ਨੂੰ ਜੋ ਹੈ ਸੈੱਟ ਕਰ ਸਕਦੇ ਹਾਂ ਜਿਵੇਂ ਸਾਡੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਪੰਜਾਬ ਦੇ ਵਿੱਚ ਬਾਰਾਂ ਹਜ਼ਾਰ ਤੋਂ ਵੱਧ ਪਿੰਡ ਹੈਗੇ ਆ ਪਿੰਡਾਂ ਦੇ ਜੀਵਨ ਸ਼ੈਲੀ ਜਿਹੜੀ ਬਹੁਤ ਵਧੀਆ ਹੈ ਅਤੇ ਪੰਜਾਬ ਦਾ ਇਤਿਹਾਸ ਹੈ ਪੰਜਾਬ ਦਾ ਪਿਛੋਕੜ ਵੀ ਰਿਹਾ ਹੈ ਪਿੰਡਾਂ ਦੇ ਨਾਲ ਹੀ ਪੰਜਾਬ ਦਾ ਜੀਵਨ ਹੈ ਅਕਸਰ ਹੀ ਗੱਲ ਕਹੀ ਜਾਂਦੀ ਹੈ ਕਹਿੰਦੇ ਪਿੰਡਾਂ ਦਾ ਜੀਵਨ ਬਹੁਤ ਵਧੀਆ ਹੁੰਦਾ ਹੈ ਕਿਉਂਕਿ ਸ਼ਾਂਤ ਵਾਤਾਵਰਨ ਹੈ ਵਧੀਆ ਪੇੜ ਪੌਦੇ ਹੈ ਹਰਿਆਲੀ ਹੈ ਅਤੇ ਸਾਨੂੰ ਆਪਣੇ ਰਾਜ ਦੇ ਬਾਰੇ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਥੇ ਜਿਹੜੀ ਫਸਲ ਬੀਜੀ ਜਾਂਦੀ ਹੈ ਉਹ ਰੁੱਤਾਂ ਦੇ ਹਿਸਾਬ ਨਾਲ ਕਣਕ ਝੋਨਾ ਨਰਮਾ ਮੂੰਗੀ ਕ ਕਮਾਦ ਆਦਿ ਵੱਖ ਵੱਖ ਸਮੇਂ ਦੇ ਦੌਰਾਨ ਵੱਖ ਵੱਖ ਰੁੱਤ ਦੇ ਅਸੀਂ ਹਿਸਾਬ ਨਾਲ ਫਸਲਾਂ ਦੀ ਬੀਜਾਈ ਕੀਤੀ ਜਾਂਦੀ ਹੈ ਇਹਦੇ ਨਾਲ ਹੀ ਰਾਜ ਦੇ ਭੂਗੋਲ ਦਾ ਵੀ ਸਾਨੂੰ ਧਰਤੀ ਦਾ ਵੀ ਗਿਆਨ ਹੋਣਾ ਚਾਹੀਦਾ ਸਾਡਾ ਜਿਹੜਾ ਪੰਜਾਬ ਦਾ ਹਿੱਸਾ ਹੈ ਕਾਫੀ ਹੱਦ ਤੱਕ ਜਿਹੜਾ ਹੈਗਾ ਹੱਦ ਜਿਹੜੀ ਆ ਪੰਜਾਬ ਦੇ ਨਾਲ ਆਪਣੇ ਰਾਜਸਥਾਨ ਦੇ ਨਾਲ ਅਤੇ ਹਰਿਆਣੇ ਦੇ ਨਾਲ ਲੱਗਦੀ ਹੈ